ਹਾਂ ਅਸੀਂ ਸਵੀਗੀ ਅਤੇ ਜਮੈਟੋ ਦੀਆਂ ਫੂਡ ਡਿਲਵਰੀ ਕੀਤੀ ਹੈ ਇਹ ਤਾਂ ਸਾਡੇ ਰੋਜ਼ ਦਾ ਕੰਮ ਹੀ ਹੋ ਗਿਆ ਹੈ ਕਿ ਜਿਵੇਂ ਅਗਰ ਤਾਂ ਸਾਨੂੰ ਘਰ ਦਾ ਹਾਂ ਕੋਈ ਭੋਜਨ ਵਗੈਰਾ ਸਵਾਦ ਨਹੀਂ ਲੱਗਦਾ ਤਾਂ ਆਪਾਂ ਕੀ ਕਰਦੇ ਹਾਂ ਆਪਾਂ ਅੱਜ ਕੱਲ੍ਹ ਔਨਲਾਈਨ ਹੀ ਇਹ ਸਭ ਚੀਜ਼ਾਂ ਮਿਲਣੀਆਂ ਸਟਾਰਟ ਹੋ ਗਈਆਂ ਅਤੇ ਉਹਨਾਂ ਨੂੰ ਕੀ ਕਰਦੇ ਹਾਂ ਕਿ ਜੋਮੈਟੋ ਦੀ ਸਾਈਡ 'ਤੇ ਜਾ ਕੇ ਉੱਥੇ ਜੋ ਚੀਜ਼ ਸਾਨੂੰ ਪਸੰਦ ਹੈ ਆਪਾਂ ਉਹਨੂੰ ਔਡਰ ਕਰ ਲੈਂਦੇ ਹਨ ਇਹ ਤਾਂ ਬਹੁਤ ਹੀ ਵਧੀਆ ਗੱਲ ਹੋ ਚੁੱਕੀ ਹੈ ਕਿਉਂਕਿ ਸਾਨੂੰ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਇਹ ਸਾਡੇ ਲਈ ਤਾਂ ਇੱਕ ਤਰ੍ਹਾਂ ਦੀ ਸੁਵਿਧਾਜਨਕ ਬਣ ਚੁੱਕੀ ਹੈ ਸਾਨੂੰ ਬਾਹਰ ਨਹੀਂ ਜਾਣਾ ਪੈਂਦਾ ਸਾਨੂੰ ਇਹ ਦੇਖਣਾ ਨਹੀਂ ਪੈਂਦਾ ਕਿ ਸਾਨੂੰ ਹੁੰਦਾ ਹੈ ਕਿ ਸਾਡੇ ਨਾਲ ਪਹਿਲੇ ਕੋਈ ਜਾਵੇ ਆਪਾਂ ਫਿਰ ਉੱਥੇ ਜਾ ਕੇ ਆਪਾਂ ਫੂਡ ਲਈਏ ਇਹ ਸਭ ਚੀਜ਼ਾਂ ਦਾ ਕੋਈ ਵੀ ਮਤਲਬ ਮੁਸ਼ਕਿਲਾਂ ਵਗੈਰਾ ਨਹੀਂ ਆਉਂਦੀਆਂ ਸਿੱਧਾ ਹੀ ਆਪਾਂ ਕੀ ਕਰਦੇ ਹਾਂ ਕਿ ਹ ਔਨਲਾਈਨ ਔਡਰ ਕਰਦੇ ਹਾਂ ਅਤੇ ਉਹ ਚੀਜ਼ ਸਾਡੇ ਘਰ ਲਾ ਕੇ ਸਾਨੂੰ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਅਤੇ ਉਹਨਾਂ ਦਾ ਫੂਡ ਡਿਲੀਵਰੀ ਦੀ ਅਗਰ ਆਪਾਂ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਹੀ ਵਧੀਆ ਹੁੰਦੀ ਹੈ ਸਵੀਗੀ ਦੀ ਫੂਡ ਡਿਲੀਵਰੀ ਜਿਵੇਂ ਕਿ ਆਪਾਂ ਅਗਰ ਪੀਜ਼ਾ ਵਗੈਰਾ ਔਡਰ ਕਰਦੇ ਹਾਂ ਹਾਂ ਅਤੇ ਉਹ ਜਿਹੜੇ ਰੈਸਟੋਰੈਂਟ ਤੋਂ ਆਪਾਂ ਪੀਜ਼ਾ ਵਗੈਰਾ ਔਡਰ ਕਰਦੇ ਹਾਂ ਪਹਿਲੇ ਆਪਾਂ ਉਹਨਾਂ ਦੀ ਰੇਟਿੰਗ ਵਗੈਰਾ ਚੈੱਕ ਕਰਦੇ ਹਾਂ ਅਗਰ ਜਿਨ੍ਹਾਂ ਦੀ ਰੇਟਿੰਗ ਫਾਈਵ ਸਟਾਰ ਹੈਗੀ ਆ ਤਾਂ ਹੀ ਆਪਾਂ ਕੀ ਕਰਦੇ ਹਾਂ ਉਹ ਔਡਰ ਵਗੈਰਾ ਕਰਦੇ ਨੇ ਅਤੇ ਉਹਨਾਂ ਦੇ ਜਿਹੜੇ ਚੀਜ਼ਾਂ ਹੁੰਦੀਆਂ ਪੀਜ਼ਾ ਵਗੈਰਾ ਉਹ ਬਹੁਤ ਹੀ ਵਧੀਆ ਫਰੈਸ਼ ਤਰ੍ਹਾਂ ਸਾਨੂੰ ਚੀਜ਼ ਪ੍ਰੋਵਾਈਡ ਕਰਦੇ ਹਾ ਅਗਰ ਆਪਾਂ ਜਮੈਟੋ ਦੀ ਗੱਲ ਕੀਤੀ ਜਾਵੇ ਤਾਂ ਜਮੈਟੋ 'ਤੇ ਜਿਵੇਂ ਕਿ ਕੋਈ ਸਬਜ਼ੀ ਵਗੈਰਾ ਆਪਾਂ ਮੰਗਵਾਉਣੀ ਹੋਵੇ ਇਹ ਉਹ ਵੀ ਉਹ ਵੀ ਆਪਾਂ ਰੇਟਿੰਗ ਪਹਿਲੇ ਚੈੱਕ ਕਰਦੇ ਹਾਂ ਜਿਨ੍ਹਾਂ ਦੀ ਰੇਟਿੰਗ ਵਧੀਆ ਹੁੰਦੀ ਆ ਉਸ ਰੈਸਟੋਰੈਂਟ ਤੋਂ ਮੰਗਾ ਦਿੰਦੇ ਹਾਂ ਤਾਂ ਬਿਲਕੁਲ ਵਧੀਆ ਤਰ੍ਹਾਂ ਦੀ ਸਬਜ਼ੀ ਵੀ ਸਾਨੂੰ ਮਿਲ ਜਾਂਦੀ ਹੈ ਤਾਂ ਮਤਲਬ ਕਿ ਇਹ ਸਾਡੇ ਲਈ ਬਹੁਤ ਹੀ ਵਧੀਆ ਤਰ੍ਹਾਂ ਦਾ ਇੱਕ ਤਰ੍ਹਾਂ ਦੇ ਲਾਭਕਾਰੀ ਹੀ ਹੀ ਹੈ